ਸਰ ਸਤਿ ਸ਼੍ਰੀ ਅਕਾਲ ਜੀ ਸਰ ਸੁਰਿੰਦਰ ਸਰ ਬੋਲਦੇ ਹੋ ਸਰ ਮੈਂ ਨਾ ਪੈਨ ਕਾਰਡ ਬਣਵਾਉਣਾ ਅਤੇ ਹਾਂਜੀ ਸਰ ਹਾਂਜੀ ਮੈਂ ਪੈਨ ਕਾਰਡ ਬਣਵਾਉਣਾ ਅਤੇ ਮੈਨੂੰ ਦੱਸ ਦਿਓ ਵੀ ਮੈਨੂੰ ਕਿਹੜੇ ਕਿਹੜੇ ਜ਼ਰੂਰੀ ਦਸਤਾਵੇਜ਼ ਚਾਹੀਦੀ ਹੈ ਜੀ ਹਾਂਜੀ ਸਰ ਮੈਨੂੰ ਨਾ ਜ਼ਰੂਰੀ ਚਾਹੀਦਾ ਪੈਨ ਕਾਰਡ ਹਾਂਜੀ ਹਾਂਜੀ ਸਰ ਮੈਂ ਮੈਂ ਆਈ ਸੀ ਜੀ ਇੱਕ ਦਿਨ ਡੀ ਸੀ ਦਫਤਰ ਹੋ ਗਏ ਸਰ ਪੰਜ ਚਾਰ ਪੰਜ ਦਿਨ ਹਾਂਜੀ ਅਤੇ ਸਰ ਮੈਂ ਨਾ ਡਾਕੂਮੈਂਟ ਭੁੱਲ ਆਈ ਜੀ ਹਾਂਜੀ ਨਾ ਹੀ ਸਰ ਮੇਰੇ ਕੋਲ ਫੋਨ 'ਚ ਸੀ ਹਾਂਜੀ ਸਰ ਸਰ ਤੁਸੀਂ ਮੈਨੂੰ ਦੱਸ ਦਿਓ ਮੈਨੂੰ ਕਿਹੜੇ ਕਿਹੜੇ ਦਸਤਾਵੇਜ਼ ਲੈ ਕੇ ਆਉਣੇ ਆ ਜੀ ਸਰ ਜੇ ਮੈਨੂੰ ਲੋੜ ਪਈ ਤਾਂ ਮੈਂ ਤੁਹਾਨੂੰ ਦੁਬਾਰਾ ਫੋਨ ਕਰੂੰਗੀ ਜੀ ਹਾਂਜੀ ਸਰ ਅਤੇ ਤੁਸੀਂ ਨਾ ਮੇਰਾ ਫੋਨ ਚੱਕ ਲਿਓ ਜੀ